ਕੁਝ ਸਥਾਨਕ ਆਵਾਜਾਈ ਦੇ ਹਨ ਜੋ ਸੈਲਾਨੀ ਪੰਜਾਬ ਦੇ ਆਲੇ ਦੁਆਲੇ ਘੁੰਮਣ ਲਈ ਵਰਤ ਸਕਦੇ ਹਨ ਜਿਵੇਂ ਬੱਸਾਂ ਰੇਲ ਗੱਡੀਆਂ ਟੈਕਸੀਆਂ 'ਤੇ ਲੋਕ ਘਰ ਬੈਠੇ ਹੀ ਉਬਰ ਜਾਂ ਔਲਾ ਕੈਬ ਨੂੰ ਬੁਲਾ ਕੇ ਆਪਣਾ ਇਹ ਆਵਾਜਾਈ ਕਰ ਸਕਦੇ ਹਨ ਜਿਵੇਂ ਜਿਵੇਂ ਕਿ ਬਾਹਰੋਂ ਕੋਈ ਆ ਫੌਰਨ ਆਉਂਦਾ ਹੈ ਤਾਂ ਉਹ ਆਟੋ ਵਾਲੇ ਨਾਲ ਆਪਣੇ ਪਿਆ ਪਿਆਰ ਮੁਹੱਬਤ ਨਾਲ ਗੱਲਬਾਤ ਕਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਹਨਾਂ ਦੇ ਆਪਸ ਵਿੱਚ ਪਿਆਰ ਰਹੇਗਾ ਅਤੇ ਉਹ ਤੇ ਕਈ ਆਟੋ ਇਸ ਤਰ੍ਹਾਂ ਹੁੰਦੇ ਹਨ ਜਿਵੇਂ ਉਹ ਲੋਕਾਂ ਕੋਲੋਂ ਬਾਹਰ ਆਏ ਫੌਰਨ ਕੋਲੋਂ ਪੈਸੇ ਲੁੱਟਦੇ ਹਨ ਅਤੇ ਇਸ ਲਈ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਬਾਹਰ ਦੇ ਸੈਲਾਨੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਸ ਵਿੱਚ ਗੱਲਬਾਤ ਕਰਨ ਪਿਆਰ ਮੁਹੱਬਤ ਨਾਲ ਰਹਿਣ ਤੇ ਤਾਂ ਕਿ ਉਹ ਕਿਸੇ ਇੱਕ ਦੂਜੇ ਨੂੰ ਲੁੱਟ ਨਾ ਸਕੇ ਅਤੇ ਅਸੀਂ ਗੱਡੀਆਂ ਰੇਲ ਗੱਡੀਆਂ ਬੱਸਾਂ ਟਰੈਕਟਰ ਵਿੱਚ ਆਪਾਂ ਇੱਕ ਦੂਜੇ ਵਿੱਚ ਸਫ਼ਰ ਕਰ ਸਕਦੇ ਹਾਂ ਇਸ ਲਈ ਸਾਨੂੰ ਆਪਣੇ ਆਪਣੇ ਵਿੱਚ ਪਿਆਰ ਮੁਹੱਬਤ ਹਮੇਸ਼ਾ ਹੀ ਰੱਖਣਾ ਚਾਹੀਦਾ ਹੈ ਇਸ ਲਈ ਤੁਹਾਨੂੰ ਇਹੀ ਸੱ ਸੱਚੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਆਪਸ ਵਿੱਚ ਪਿਆਰ ਮੁਹੱਬਤ ਰੱਖੋ ਅਤੇ ਤਾਂ ਜੋ ਫੌਰਨ ਲੋਕ ਆ ਕੇ ਇੱਥੋਂ ਦੇ ਆਵਾਜਾਈ ਕਰ ਸਕਣ ਅਤੇ ਆਪਣੀਆਂ ਵਾਰ ਵਾਰ ਸੈਲਾਨੀਆਂ ਵਿੱਚ ਘੁੰਮ ਸ ਸੂ ਘੁੰਮ ਸਕਣ